ਮੈਂ ਪਟਿਆਲੇ ਜ਼ਿਲ੍ਹੇ ਨਾਲ਼ ਸੰਬੰਧਿਤ ਹਾਂ ਇੱਥੇ ਬਹੁਤ ਸਾਰੀਆਂ ਥਾਵਾਂ ਘੁੰਮਣ ਫਿਰਨ ਨੂੰ ਬਹੁਤ ਸਾਰੀਆਂ ਥਾਵਾਂ ਹਨ ਜਿਵੇਂ ਕਿ ਕਾਲੀ ਮਾਤਾ ਦਾ ਮੰਦਰ ਅਤੇ ਦੁੱਖ ਨਿਵਾਰਨ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਆਏ ਸੀਗੇ ਅਤੇ ਆਪਣਾ ਮੋਤੀ ਬਾਗ ਗੁਰਦੁਆਰਾ ਇੱਥੇ ਵੀ ਗੁਰੂ ਤੇਗ ਬਹਾਦਰ ਜੀ ਆਏ ਹੈ ਇਹਨਾਂ ਨੇ ਇੱਥੇ ਇੱਕ ਰਾਤ ਕੱਟੀ ਘੋੜਾ ਬੰਨ੍ਹਿਆ ਅਤੇ ਅਸੀਂ ਦੋਹੇ ਟਾਈਮ ਕਾਲੇ ਦੁੱਖ ਮੋਤੀ ਬਾਗ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਅਤੇ ਸ਼ੀਸ਼ ਮਹਿਲ ਹੈ ਜਿੱਥੇ ਕਿ ਹੈਰੀਟੇਜ ਮੇਲਾ ਲੱਗਦਾ ਹੈ ਬੜੀ ਦੂਰੋਂ ਦੂਰ ਦੀ ਲੋਕ ਆਉਂਦੇ ਆ ਅਤੇ ਕਲਾਕਾਰ ਆਉਂਦੇ ਆ ਅਤੇ ਕਿਲ੍ਹਾ ਚੌਂਕ ਹੈ ਉੱਥੇ ਬਾਬੇ ਵਾਲੀ ਜੋਤ ਜੋਤ ਜਗਦੀ ਹੈ ਜਦੋਂ ਕਿ ਜੋਤ ਬੁਝ ਗਈ ਉਸੀ ਟਾਈਮ ਇਹ ਪਟਿਆਲਾ ਤਬਾਹ ਹੋ ਜਾਣਾ ਉੱਥੇ ਰਾਜਿਆਂ ਮਹਾਰਾਜਿਆਂ ਦੇ ਅਸਤਰ ਸ਼ਸਤਰ ਆ ਅਤੇ ਇੱਥੇ ਨਾਲ਼ ਹੀ ਪੋਲੋ ਗਰਾਊਂਡ ਹੈ ਇੱਥੇ ਲੋਕ ਬੜੇ ਸੈਲਾਨੀ ਆਉਂਦੇ ਆ ਘੁੰਮਣ ਫਿਰਨ ਬਹੁਤ ਸਾਰੀ ਜਗ੍ਹਾਵਾਂ ਹਨ